ਅੱਜ ਕੱਲ ਦੇ ਜੀਵਨ ਵਿੱਚ ਪਾਣੀ ਦੀ ਬਹੁਤ ਮਹੱਤਤਾ ਹੈ ਅਸੀਂ ਵਿਆਹ ਵਰਗੇ ਵੱਡੇ ਸਮਰੋਹਾਂ ਦੇ ਵਿੱਚ ਪਾਣੀ ਦਾ ਅਰੇਂਜਮੈਂਟ ਵਾਸਤੇ ਕਈ ਵਾਰੀ ਅਸੀਂ ਪਾਣੀ ਦੇ ਟੈਂਕਰ ਮੰਗਵਾਦੇ ਹਾਂ ਜਾਂ ਕਈ ਵਾਰੀ ਅਸੀਂ ਪਾਣੀ ਟੈਂਕਰ ਮੰਗਵਾ ਕੇ ਤੇ ਉਹਨਾਂ ਪਾਣੀ ਦੀ ਗਲਤ ਵਰਤੋਂ ਨਾ ਹੋਵੇ ਉਹਦੇ ਬਾਰੇ ਅਸੀਂ ਬਹੁਤ ਧਿਆਨ ਰੱਖਦੇ ਹਾਂ ਵਿਆਹ ਦੇ ਵੱਡੇ ਸਮਰੋਹਾਂ ਵਿੱਚ ਅਸੀਂ ਕਈ ਵਾਰੀ ਕੰਪਨੀਆਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਤੇ ਕੰਪਨੀਆਂ ਤੋਂ ਪਾਣੀ ਮੰਗਾਂਦੇ ਆ ਤੇ ਪਾਣੀ ਨੂੰ ਅਸੀਂ ਵੀ ਖਰਾਬ ਨਾ ਕਰੀਏ ਇਹ ਸਾਰਿਆਂ ਨੂੰ ਕਹਿੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਸਾਨੂੰ ਬਹੁਤ ਲੋੜ ਹੈ ਪਾਣੀ ਅਸੀਂ ਘੱਟ ਤੋਂ ਘੱਟ ਵਰਤਣਾ ਚਾਹੀਦਾ ਹੈ ਤੇ ਪਾਣੀ ਖਰਾਬ ਨਹੀਂ ਕਰਨਾ ਚਾਹੀਦਾ ਪਾਣੀ ਸਾਡੀ ਸਿਹਤ ਦੇ ਲਈ ਬਹੁਤ ਜਰੂਰੀ ਹੈ ਤੇ ਇਸ ਗੱਲ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਣੀ ਦਾ ਪ੍ਰਬੰਧ ਜੀਵਨ ਵਾਸਤੇ ਬਹੁਤ ਜਰੂਰੀ ਹੈ ਤੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤੇ ਪਾਣੀ ਦੀ ਵਰਤੋਂ ਜਾਣੀ ਕੀ ਸਾਰਿਆਂ ਵਾਸਤੇ ਹੋਣੀ ਚਾਹੀਦੀ ਹੈ ਪਾਣੀ ਸਾਡੀ ਸਿਹਤ ਦੇ ਲਈ ਬਹੁਤ ਜਰੂਰੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਜੇ ਅਸੀਂ ਪਾਣੀ ਦੀ ਵਰਤੋਂ ਨੂੰ ਸਹੀ ਤਰਾਂ ਇਸਤੇਮਾਲ ਨਹੀਂ ਕੀਤਾ ਤੇ ਸਾਡਾ ਪਾਣੀ ਸਾਨੂੰ ਪਾਣੀ ਦੀ ਬਹੁਤ ਦਿੱਕਤ ਆਏਗੀ ਪਾਣੀ ਸਾਡੇ ਜੀਵਨ ਦਾ ਬਹੁਤ ਅਨਮੁਲ ਖਜਾਨਾ ਹੈ ਸਾਨੂੰ ਪਾਣੀ ਪਾਣੀ ਵਾਸਤੇ ਪਾਣੀ ਚੰਗੀ ਤਰ੍ਹਾਂ ਵਰਤਣਾ ਚਾਹੀਦਾ ਹੈ ਤੇ ਬਾਕੀ ਸਾਰਿਆਂ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਪਾਣੀ ਨੂੰ ਚੰਗੀ ਤਰ੍ਹਾਂ ਇਸਤੇਮਾਲ ਕੀਤਾ ਜਾਵੇ ਇਹਦੀ ਵੇਸਟੇਜ ਨੂੰ ਰੋਕਿਆ ਜਾਵੇ ਪਾਣੀ ਸਾਡੇ ਲਈ ਬਹੁਤ ਜ਼ਰੂਰੀ ਹੈ